ਪੰਜ ਪਲੱਸ ਆਬ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਇਹ ਪਾਣੀ ਦੀ ਕਮੀ ਪ੍ਰਦੂਸ਼ਣ ਖੇਤੀਬਾੜੀ ਉਪਜਾਊ ਜ਼ਮੀਨ ਘੱਟ ਗਈ ਹੈ ਪੰਜਾਬ ਵਿੱਚ ਪਾਣੀ ਦੀ ਕਮੀ ਪਹਿਲਾਂ ਪਾਣੀ ਪੰਜਾਹ ਫੁੱਟ 'ਤੇ ਮਿਲ ਜਾਂਦਾ ਸੀ ਅਤੇ ਹੁਣ ਡੇਢ ਸੌ ਫੁੱਟ 'ਤੇ ਨਹੀਂ ਮਿਲਦਾ ਜਿਵੇਂ ਜਿਵੇਂ ਆਬਾਦੀ ਵੱਧਦੀ ਹੈ ਪਾਣੀ ਦੀ ਕਮੀ ਘੱਟਦੀ ਜਾ ਰਹੀ ਹੈ ਪੀਣ ਨੂੰ ਵੀ ਪਾਣੀ ਬਹੁਤ ਮੁਸ਼ਕਿਲ ਮਿਲਦਾ ਹੈ ਅਤੇ ਪ੍ਰਦੂਸ਼ਣ ਜਿਵੇਂ ਗੱਡੀਆਂ ਅਤੇ ਮੋਟਰਸਾਈਕਲ ਬਹੁਤ ਜ਼ਿਆਦਾ ਕਾਰਾਂ ਜੀ ਜੀਪਾਂ ਵੱਧ ਗਈਆਂ ਹਨ ਅਤੇ ਫੈਕਟਰੀਆਂ ਵੱਧ ਗਈਆਂ ਹਨ ਅਤੇ ਇਸ ਦੇ ਕਾਰਨ ਬਹੁਤ ਧੂਆਂ ਫੈਲਦਾ ਹੈ ਅਤੇ ਪ੍ਰਦੂਸ਼ਣ ਵੱਧਦਾ ਹੈ ਖੇਤੀਬਾੜੀ ਉਪਜਾਊ ਜ਼ਮੀਨ ਉੱਤੇ ਰੇਹਾਂ ਸਪਰੇਆਂ ਕਰਕੇ ਇਹਦੀ ਉਪਜਾਊ ਮਿੱਟੀ ਘੱਟਦੀ ਜਾਂਦੀ ਹੈ ਅਤੇ ਫਸਲ ਚੰਗੀ ਤਰ੍ਹਾਂ ਨਹੀਂ ਹੁੰਦੀ ਅਤੇ ਉਪਜਾਊ ਜ਼ਮੀਨਾਂ ਘੱਟਦੀਆਂ ਜਾਂਦੀਆਂ ਹਨ ਅਤੇ ਪਾਣੀ ਵੀ ਬਹੁਤ ਘੱਟ ਘੱਟਦਾ ਜਾ ਰਿਹਾ ਹੈ ਪੰਜਾਬ ਵਿੱਚ ਹੁਣ ਤਿੰਨ ਦਰਿਆ ਰਹਿ ਗਏ ਹਨ ਰਾਵੀ ਸਤਲੁਜ ਬਿਆਸ ਅਤੇ ਪੰਜਾਬ ਨੂੰ ਪੰਜ ਦਰਿਆਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਚੁਣੌਤੀਆਂ ਪਾਣੀ ਦੀ ਚੁਣੌਤੀ ਅਤੇ ਪ੍ਰਦੂਸ਼ਣ ਅਤੇ ਉਪਜਾਊ ਮਿੱਟੀ ਘੱਟਦੀ ਜਾਂਦੀ ਹੈ ਅਤੇ ਇਸ ਦੇ ਲਈ ਇਹ ਸਾਰੀਆਂ ਪੰਜਾਬ ਦੀਆਂ ਚੁਣੌਤੀਆਂ ਹਨ